ਹੈਲੋ ਹਾਂਜੀ ਕੌਣ ਬੋਲ ਹਾਂਜੀ ਅੱਛਾ ਜੀ ਲਖਬੀਰ ਸਿੰਘ ਬੋਲਦੇ ਹੋ ਤੁਸੀਂ ਅੱਛਾ ਜੀ ਅੱਛਾ ਜੀ ਬੱਚਾ ਲਾਉਂਦੇ ਜੀ ਹੈਂ ਕਿਹੜੀ ਕਲਾਸ 'ਚ ਲਾਉਣਾ ਤੁਨਾਂ ਜੀ ਅੱਛਾ ਦਸਵੀਂ 'ਚ ਲਾਉਣਾ ਜੀ ਠੀਕ ਹੈ ਜੀ ਤੇ ਇੱਕ ਤਾਂ ਹੈਗਾ ਜੀ ਸਕੂਲ ਉਰੇ ਮਾਤਾ ਗੁਜਰੀ ਸਕੂਲ ਹੈ ਤੇ ਇੱਕ ਜ਼ੋਰਾਵਰ ਸਿੰਘ ਸਕੂਲ ਹੈ ਜੀ ਉਰੇ ਜੋਤੀ ਸਰੂਪ ਮੋੜਾਂ 'ਤੇ ਵੈਸੇ ਤਾਂ ਸਰ ਜੀ ਦੇਖੋ ਜੀ ਮੇਰੇ ਵਾਸਤੇ ਤਾਂ ਮੇਰੇ ਬੱਚੇ ਪੜ੍ਹਦੇ ਨੇ ਜੀ ਵਧੀਆ ਸਕੂਲ ਤਾਂ ਜ਼ੋਰਾਵਰ ਸਕੂਲ ਹੈ ਜੀ ਅਤੇ ਸਾਰਾ ਕੁਛ ਵਧੀਆ ਜੀ ਉਰੇ ਫੀਸਾਂ ਤਾਂ ਤੁਹਾਨੂੰ ਪਤਾ ਅੱਜ ਕੱਲ੍ਹ ਸਾਰੇ ਸਕੂਲਾਂ 'ਚ ਵੱਧ ਏ ਹੁੰਦੀਆਂ ਨੇ ਹਾਂ ਸਕੂਲ ਤਾਂ ਹੋਰ ਵੀ ਜਿੱਦਾਂ ਪੰਦਰਾਂ ਅ ਕ ਹਜ਼ਾਰ ਰੁਪਇਆ ਤਾਂ ਹੈਗੀ ਓ ਹੈ ਜੀ ਫੀਸ ਹਾਂ ਬੱਸ ਬੱਸ ਵੀ ਜਾਂਦੀ ਹੈ ਜੀ ਅਤੇ ਪੜ੍ਹਾਈ ਬਹੁਤ ਵਧੀਆ ਟੀਚਰ ਵਧੀਆ ਨੇ ਜੀ ਉਰੇ ਮੇਰੇ ਬੱਚੇ ਸ਼ੁਰੂ ਤੋਂ ਹੀ ਉਰੀ ਪੜ੍ਹਦੇ ਨੇ ਜੀ ਜ਼ੋਰਾਵਰ 'ਚ ਹਾਂਜੀ ਇਹਦਾ ਗਰਾਊਂਡ ਵਧੀਆ ਜੀ ਫੁੱਟਬਾਲ ਗਰਾਊਂਡ ਵਾਲੀਬਾਲ ਗਰਾਊਂਡ ਅਤੇ ਹੋਰ ਹਾਕੀ ਗਰਾਊਂਡ ਅਤੇ ਵਾਲੀਬਾਲ ਗਰਾਊਂਡ ਸਾਰੇ ਗਰਾਊਂਡ ਹੈਗੇ ਨੇ ਜੀ ਉਰੇ ਅਤੇ ਪੜ੍ਹਾਉਣ ਵਾਸਤੇ ਟੀਚਰ ਬਹੁਤ ਵਧੀਆ ਰੱਖੇ ਵੇ ਨੇ ਜੀ ਬੱਸ ਵੀ ਲੱਗੀ ਵੀ ਹੈ ਜੀ ਸਕੂਲ ਆਪਣੇ ਉਰੇ ਪ੍ਰਿੰਸੀਪਲ ਹੈਗੇ ਜੀ ਗੁਰਭੇਜ ਸਿੰਘ ਜੀ ਹਾਂਜੀ ਹਾਂਜੀ ਜੀ ਉਰੇ ਟੀਚਰ ਹੈਗੇ ਨੇ ਜੀ ਵਧੀਆ ਤੋਂ ਵਧੀਆ ਰੱਖੇ ਵੇ ਨੇ ਜੀ ਦਸ ਬਾਰਾਂ ਟੀਚਰ ਤਾਂ ਹੈਗੇ ਨੇ ਜੀ ਹਾਂਜੀ ਹਾਂਜੀ ਬੱਚਿਆਂ ਦੀ ਗਿਣਤੀ ਹੈਗੀ ਆ ਜੀ ਮੈਨੂੰ ਲੱਗਦਾ ਵੀ ਚਾਰ ਪੰਜ ਸੌ ਬੱਚਾ ਜੀ ਇਸ ਸਕੂਲ 'ਚ ਪੜ੍ਹਦਾ ਤੁਸੀਂ ਦਸਵੀਂ ਕਲਾਸ 'ਚ ਐਡਮਿਸ਼ਨ ਕਰਾਉਣੀ ਹੈ ਜੀ ਬੱਚੇ ਦੀ ਅੱਛਾ ਜੀ ਵੈਸੇ ਐਡਮਿਸ਼ਨ ਤਾਂ ਮਿਲਦੀ ਹੈ ਜੀ ਔਖੀ ਚਲੋ ਆਪਣਾ ਬੰਦਾ ਹੈਗਾ ਜੀ ਉੱਥੇ ਆਪਾਂ ਕਹਿ ਕਹਾ ਕੇ ਤੁਹਾਡੀ ਐਡਮਿਸ਼ਨ ਕਰਾ ਦਾਂਗੇ ਉੱਥੇ ਬਸ ਆਪਣਾ ਤੁਸੀਂ ਦੇਖ ਲਿਓ ਜਦੋਂ ਤੁਹਾਡਾ ਠੀਕ ਲੱਗਿਆ ਮੇਰੇ ਨਾਲ ਕੰਟੈਕਟ ਕਰ ਲਿਓ ਫ਼ੋਨ 'ਤੇ ਤਾਂ ਤੁਸੀਂ ਮੈਂ ਤੁਹਾਨੂੰ ਦੱਸ ਦੂੰਗਾ ਨਤੀਜਾ ਜੀ ਐਨ ਵਧੀਆ ਆ ਰਿਹਾ ਜੀ ਹੁਣ ਤੱਕ ਤਾਂ ਵਧੀਆ ਆ ਰਿਹਾ ਜੀ ਚਲੋ ਤੁਸੀਂ ਐਂ ਐਂ ਕਰਿਓ ਤੁਸੀਂ ਆ ਜਿਓ ਤੁਹਾਡੀ ਐਡਮਿਸ਼ਨ ਕਰਾ ਦਾਂਗੇ ਚੰਗਾ ਜੀ ਠੀਕ ਹੈ ਜੀ ਓਕੇ ਜੀ